ਭੰਗੜੇ ਦਾ ਨਾਮ ਸੁਣ ਕੇ ਹੀ ਦਿਲ ਵਿੱਚ ਜੋਸ਼ ਭਰ ਜਾਂਦਾ ਅਤੇ ਇੱਦਾਂ ਹੁੰਦਾ ਕਿ ਜਾ ਕੇ ਭੱਜੋ ਅਤੇ ਨੱਚੋ ਟੱਪੋ ਲੋਕਾਂ ਨੂੰ ਦੇਖ ਕੇ ਸਾਨੂੰ ਇੱਕ ਮਨ ਦੇ ਵਿੱਚ ਅਜਿਹੀ ਦਿਲਚਸਪੀ ਆ ਜਾਂਦੀ ਹੈ ਕਿ ਸਾਨੂੰ ਵੀ ਹੁੰਦਾ ਕਿ ਅਸੀਂ ਵੀ ਇੱਦਾਂ ਖੁਸ਼ੀ ਦੇ ਵਿੱਚ ਝੂੰਮ ਜਾਈਏ ਅਤੇ ਭੰਗੜਾ ਆਰੋਬਿਕਸ ਦੀ ਹੀ ਕਲਾਸ ਦਾ ਪਹਿਲਾ ਦਿਨ ਇੱਕ ਮਤਲਬ ਕਾਰਡੀਓ ਭੰਗੜਾ ਐਰੋਬਿਕਸ ਕਾਰਡੀਓ ਕਸਰਤ ਦੀ ਤਰੀਕੇ ਨਾਲ ਤੁਸੀਂ ਇਹਨੂੰ ਲੈ ਸਕਦੇ ਹੋ ਅਤੇ ਇਹਦੇ ਵਿੱਚ ਸਰੀਰ ਦਾ ਪੂਰਾ ਜੋਸ਼ ਲੱਗ ਜਾਂਦਾ ਅਤੇ ਜਦੋਂ ਮੇਰਾ ਪਹਿਲਾ ਦਿਨ ਸੀ ਉੱਥੇ ਇਸ ਕਲਾਸ ਦੇ ਵਿੱਚ ਮੁੰਡੇ ਅਤੇ ਕੁੜੀਆਂ ਭੰਗੜੇ ਅਤੇ ਦੇ ਬਹੁਤ ਹੀ ਵਧੀਆ ਗਾਣੇ ਲੱਗੇ ਹੋਏ ਸਨ ਅਤੇ ਉਹ ਆਪਣਾ ਸਰੀਰਕ ਕਸਰਤ ਕਰ ਰਹੇ ਸਨ ਅਤੇ ਉਹ ਭੰਗੜੇ ਦੇ ਅ ਅੱਛੇ ਸਟੈਪਸ ਨੂੰ ਕਰਕੇ ਉਹਨਾਂ ਨੂੰ ਦੇਖਿਆ ਮੈਂ ਮੈਨੂੰ ਵੀ ਬਹੁਤ ਖੁਸ਼ੀ ਹੋਈ ਮੇਰਾ ਵੀ ਮਨ ਕੀਤਾ ਕਿ ਮੈਂ ਉਥੇ ਜਾ ਕੇ ਉਹਨਾਂ ਦੇ ਨਾਲ ਭੰਗੜਾ ਕਰਾਂ ਅਤੇ ਆਪਣੇ ਆਪ ਇੱਕ ਮਸਤੀ ਦੇ ਵਿੱਚ ਝੂੰਮ ਲਵਾਂ ਪਰ ਫਿਰ ਜਦੋਂ ਉਹਨਾਂ ਦਾ ਟਾਈਮ ਖਤਮ ਹੋਇਆ ਉਸ ਤੋਂ ਬਾਅਦ ਸਾਡੀ ਵਾਰੀ ਆਈ ਫਿਰ ਸਾਡੇ ਕੋਰੀਅਰਗਰਾਫਰ ਨੇ ਸਾਨੂੰ ਖੜ੍ਹਾ ਕੀਤਾ ਅਸੀਂ ਅੱਠ ਤੋਂ ਦਸ ਜਾਣੇ ਸੀ ਮੁੰਡੇ ਵੀ ਸਨ ਕੁੜੀਆਂ ਵੀ ਸਨ ਅਤੇ ਅਸੀਂ ਘੁੰਮੇ ਉਹਨਾਂ ਦੇ ਨਾਲ ਬਹੁਤ ਹੀ ਇਜ਼ੀ ਸਾਨੂੰ ਜਿਹੜੇ ਸੀਗੇ ਭੰਗੜੇ ਦੇ ਸਟੈਪ ਕਰਵਾਏ ਗਏ ਅਤੇ ਅਸੀਂ ਉਹਨਾਂ ਕੋਰੀਗ੍ਰਾਫਰ ਦੇ ਸਟੈਪਸ ਨੂੰ ਕੀ ਦੇਖ ਦੇਖ ਕੇ ਕਾਪੀ ਕੀਤਾ ਅਤੇ ਉਸ ਤੋਂ ਬਾਅਦ ਸਾਨੂੰ ਬਹੁਤ ਮਜ਼ਾ ਆਇਆ ਉਸ ਤੋਂ ਬਾਅਦ ਸਰੀਰ ਦੀ ਇੱਕ ਅੱਛੀ ਕਸਰਤ ਹੋਈ ਸਾਡੇ ਸਾਡਾ ਪੂਰਾ ਜ਼ੋਰ ਲੱਗਿਆ ਸਾਨੂੰ ਥਕਾਨ ਵੀ ਮਹਿਸੂਸ ਹੋ ਰਹੀ ਸੀ ਪਰ ਇੱਕ ਅਲੱਗ ਖੁਸ਼ੀ ਵੀ ਸੀ ਅਤੇ ਇਹਦੇ ਨਾਲ ਅਸੀਂ ਆਪਣਾ ਪੂਰਾ ਦਿਨ ਬਿਤਾਇਆ ਅਤੇ ਮੇਰਾ ਦਿਨ ਬਹੁਤ ਹੀ ਵਧੀਆ ਅਤੇ ਯਾਦਗਾਰ ਦਿਨ ਸੀ ਧੰਨਵਾਦ